ਪਿੱਛੇ ਜਿਹੇ ਮੈਨੂੰ ਕੇਰਲਾ ਦੀ ਯਾਤਰਾ ਰੇਲ ਰਾਹੀਂ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਅਤੇ ਮੈਨੂੰ ਬੜੀ ਖੁਸ਼ੀ ਸੀਗੀ ਰੇਲ ਗੱਡੀ ਦੇ ਵਿੱਚ ਏ ਸੀ ਵਾਲੇ ਡੱਬੇ 'ਚ ਬੈਠਾਂਗੇ ਜਦੋਂ ਅਸੀਂ ਅੰਬਾਲੇ ਤੋਂ ਚੜ੍ਹੇ ਤਾਂ ਅਸੀਂ ਰੇਲ ਗੱਡੀ 'ਚ ਬੈਠੇ ਤਾਂ ਕੈਬਨ ਦੇ ਵਿੱਚ ਜਾਂਦੇ ਸਾਰ ਹੀ ਐਨੀਆਂ ਸੋਹਣੀਆਂ ਸੀਟਾਂ ਲੱਗੀਆਂ ਐਨਾ ਵਧੀਆ ਕੈਬਨ ਲੱਗਿਆ ਅਤੇ ਉੱਥੇ ਆਵਾਜ਼ ਇੰਜਣ ਦੀ ਛੂੰ ਛੂੰ ਕਰਦੀ ਜਦੋਂ ਮੋੜ ਤੋਂ ਆਉਂਦੀ ਸਾਨੂੰ ਇੰਨੀ ਸ ਸੋਹਣੀ ਲੱਗਦੀ ਉਹ ਅਤੇ ਅਸੀਂ ਕਦੇ ਬਾਰੀ 'ਚ ਬਾਹਰ ਖੜ੍ਹ ਜਾਂਦੇ ਜਾ ਕੇ ਬਾਹਰ ਖੜ੍ਹਦੇ ਦੇਖ ਕੇ ਗੱਡੀ ਦੇ ਐਡੇ ਐਡੇ ਪਹੀਏ ਯਾਰ ਆ ਹੱਦ ਹੈ ਯਾਰ ਵਾਹ ਯਾਰ ਟਰੈਕ ਲਾਈਨਾਂ ਹੋਰ ਰੇਲ ਗੱਡੀ ਜਿਹੜੀ ਚੀਜ਼ ਬਣਾਈ ਹੈ ਵਾਕਈ ਦੇਸ਼ ਦੀ ਬਹੁਤ ਵੱਡੀ ਤਰੱਕੀ ਕੀਤੀ ਗਈ ਹੈ ਇਸ ਚੀਜ਼ 'ਤੇ ਅਤੇ ਹਾਂ ਮੈਨੂੰ ਰੇਲ ਗੱਡੀ ਦਾ ਸਫਰ ਬਹੁਤ ਵਧੀਆ ਲੱਗਿਆ